ਸਾਡੇ ਖੇਤਰ ਵਿੱਚ ਲੋਕ ਗੀਤ ਬਹੁਤ ਹੀ ਪ੍ਰਸਿੱਧ ਸੀ ਅਤੇ ਪੰਜਾਬ ਵਿੱਚ ਲੋਕ ਗੀਤ ਬਹੁਤ ਹੀ ਜ਼ਿਆਦਾ ਮਤਲਬ ਪ੍ਰਸਿੱਧ ਹਨ ਬਹੁਤ ਹੀ ਜ਼ਿਆਦਾ ਮਨਮੋਹਕ ਹਨ ਅਤੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਸੀ ਲੋਕ ਗੀਤਾਂ ਨੂੰ ਜਿਵੇਂ ਕਿ ਕੁੜੀ ਦੇ ਵਿਆਹ 'ਚ ਸੁਹਾਗ ਗਾਏ ਜਾਂਦੇ ਸੀ ਮੁੰਡੇ ਦੇ ਵਿਆਹ ਵਿਚ ਘੋੜੀਆਂ ਗਾਈਆ ਜਾਂਦੀਆਂ ਸੀ ਅਤੇ ਜਦੋਂ ਵੀ ਕੋਈ ਮਹਿੰਦੀ ਜਾਂ ਲੈਡੀ ਸੰਗੀਤ ਦਾ ਫੰਕਸ਼ਨ ਹੁੰਦਾ ਸੀਗਾ ਸਾਰੀ ਬੁੱਢੀਆਂ ਇਕੱਠੇ ਹੋ ਕੇ ਹੇਕ ਵਾਲੇ ਗਾਣੇ ਗਾਉਂਦੀਆਂ ਸੀ ਗੀਤ ਗਾਉਂਦੀਆਂ ਸੀ ਪਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬੱਚਿਆਂ ਨੂੰ ਇਵੇਂ ਹੈ ਕਿ ਉਹ ਸਿਰਫ ਡੀ ਜੇ ਲਾਉਣ ਅਤੇ ਆਪਦੇ ਜਿਨ ਮਨ ਮਨਪਸੰਦ ਅੱਜ ਕੱਲ੍ਹ ਦੇ ਗਾਣੇ ਲਾ ਕੇ ਉਹਨਾਂ ਦੇ ਉੱਤੇ ਨੱਚਣ ਉਹਨਾਂ ਨੂੰ ਕੋਈ ਵੀ ਨੋਲੇਜ ਨਹੀਂ ਹੈ ਵੀ ਪਿਛਲੇ ਜ਼ਮਾਨੇ ਵਿੱਚ ਕੀ ਗੀਤ ਗਾਏ ਜਾਂਦੇ ਸੀ ਅਤੇ ਅੱਜ ਕੱਲ੍ਹ ਜਦੋਂ ਵੀ ਬੁੱਢੀਆਂ ਆਪਦਾ ਜਦੋਂ ਗੀਤ ਗਾਣ ਲੱਗ ਗਈਆਂ ਹੇਕ ਵਾਲੇ ਅਤੇ ਸਾਰੇ ਜਵਾਕ ਮੂੰਹ ਸਜਾ ਕੇ ਬਹਿ ਜਾਂਦੇ ਹਨ ਕਿ ਕਦੋਂ ਬੁੱਢੀਆਂ ਖਤਮ ਕਰਨ ਅਤੇ ਅਸੀਂ ਆਪਦੇ ਡੀ ਜੇ ਲਾਈਏ ਅਤੇ ਉਹਨਾਂ ਉੱਤੇ ਨੱਚੀਏ ਪਰ ਇਹਨਾਂ ਨੂੰ ਨਹੀ ਪਤਾ ਕਿ ਇਹ ਸਾਰੇ ਜੋ ਜਿੰਨੇ ਵੀ ਗੀਤ ਹਨ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਪਹਿਲਾਂ ਦੇ ਜ਼ਮਾਨੇ 'ਚ ਇਹਨਾਂ ਨੂੰ ਸੁਣਨ ਸੁਣਨਾ ਵੀ ਬਹੁਤ ਹੀ ਵਧੀਆ ਲੱਗਦਾ ਸੀ ਜੇ ਅੱਜ ਕੱਲ੍ਹ ਦੇ ਜਵਾਕ ਇਹਨਾਂ ਨੂੰ ਸੁਣਨ ਧਿਆਨ ਨਾਲ ਇਹਨਾਂ 'ਤੇ ਕੋ ਕੋਂਸਨਟ੍ਰੇਸ਼ਨ ਕਰਨ ਤਾਂ ਉਹਨਾਂ ਨੂੰ ਵੀ ਇਹ ਗਾਣੇ ਮਤਲਬ ਇਹਨਾਂ ਗੀਤ ਬਹੁਤ ਵਧੀਆ ਲੱਗਣ ਬਹੁਤ ਹੀ ਪਿਆਰੇ ਮਨਮੋਹਕ ਲੱਗਣ ਪਰ ਉਹਨਾਂ ਨੂੰ ਅੱਜ ਕੱਲ੍ਹ ਆਪਦੇ ਬਸ ਐਂਟਰਟੇਨਮੈਂਟ ਦੇ ਦੂਜੇ ਗਾਣੇ ਹੀ ਚਾਹੀਦੇ ਹਨ ਤਾਂ ਪਰ ਲੋਕ ਗੀਤ ਸਾਡੇ ਲਈ ਬਹੁਤ ਵਧੀਆ ਹਨ